ਬਹੁਤ ਹਨ ਜਿਹੜੀਆਂ ਕਿ ਮੈਨੂੰ ਪਸੰਦ ਹਨ ਪਰ ਸਾਰਿਆਂ ਨਾਲੋਂ ਜ਼ਿਆਦਾ ਮੈਨੂੰ ਘੁੰਮਣਾ ਪਸੰਦ ਹੈ ਮੈਨੂੰ ਪੁਰਾਣੀਆਂ ਅਤੇ ਧਾਰਮਿਕ ਜਗ੍ਹਾ 'ਤੇ ਘੁੰਮਣਾ ਬਹੁਤ ਪਸੰਦ ਹੈ ਅਤੇ ਇੱਕ ਤਾਂ ਇਹਦੇ ਵਿੱਚ ਇਹਦੇ ਵਿੱਚ ਅਸੀਂ ਨਵੇਂ ਨਵੇਂ ਲੋਕਾਂ ਨੂੰ ਮਿਲਦੇ ਹਾਂ ਹੈਂ ਜੀ ਦਿਮਾਗੀ ਤੌਰ 'ਤੇ ਸਾਡੀ ਨੌਲੇਜ ਵੱਧਦੀ ਹੈ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਸਾਨੂੰ ਬਿਹੇਵ ਦਾ ਪਤਾ ਲੱਗਦਾ ਹੈ ਹੈਂ ਕੌਣ ਕਿਵੇਂ ਦਾ ਹੈ ਅਤੇ ਸਾਨੂੰ ਉਸੇ ਜਗ੍ਹਾ ਪਰ ਨੌਲੇਜ ਮਿਲਦੀ ਹੈ ਇਹ ਜਗ੍ਹਾ ਕਿਵੇਂ ਬਣੀ ਹੈ ਕਦੋਂ ਬਣੀ ਹੈ ਅਤੇ ਕਿਹਨੇ ਬਣਾਈ ਹੈ ਸਾਨੂੰ ਹਰੇਕ ਚੀਜ਼ ਦੀ ਮਹੱਤਤਾ ਦਾ ਪਤਾ ਲੱਗਦਾ ਜਿਸ ਕਰਕੇ ਮੈਨੂੰ ਘੁੰਮਣਾ ਬਹੁਤ ਜ਼ਿਆਦਾ ਪਸੰਦ ਹੈ ਕਈ ਥਾਵਾਂ 'ਤੇ ਮੈਂ ਘੁੰਮ ਕੇ ਆਇਆ ਹਾਂ